ਵੱਖ ਵੱਖ ਧਰਮਾਂ ਦੀਆਂ ਵੱਖ ਵੱਖ ਰੀਤਾਂ ਹਨ ਜਿਵੇਂ ਕਿ ਰੰਗੋਲੀ ਜੋ ਕਿ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਬਣਾਈ ਜਾਂਦੀ ਹੈ ਅਤੇ ਸੂਰਜ ਨੂੰ ਪਾਣੀ ਚੜ੍ਹਾਉਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਅਤੇ ਮੱਥੇ 'ਤੇ ਸੰਧੂਰ ਲਗਾਉਣਾ ਇੱਕ ਸੁਹਾਗਣ ਦੀ ਨਿਸ਼ਾਨੀ ਹੈ ਅਤੇ ਪਵਿੱਤਰ ਧਾਗਾ ਪਾਉਣਾ ਜੋ ਕਿ ਸਾਨੂੰ ਮਾੜੀਆਂ ਕੁਰੀਤੀਆਂ ਅਤੇ ਚੀਜ਼ਾਂ ਤੋਂ ਬਚਾਉਂਦਾ ਹੈ ਅਤੇ ਪੂਜਾ ਲਈ ਮੰਦਰ ਜਾਣਾ ਜੋ ਕਿ ਹਰੇਕ ਧਰਮ ਦਾ ਉਪਦੇਸ਼ ਹੈ ਜਿਵੇਂ ਕਿ ਜੋ ਸਿੱਖ ਹਨ ਉਹ ਗੁਰਦੁਆਰੇ ਵਿੱਚ ਜਾਂਦੇ ਹਨ ਅਤੇ ਜੋ ਬ੍ਰਾਹਮਣ ਹਨ ਉਹ ਮੰਦਰ ਵਿੱਚ ਜਾਂਦੇ ਹਨ ਪੂਜਾ ਕਰਨਾ ਸਾਡੇ ਮਨ ਨੂੰ ਸ਼ਾਂਤੀ ਦੇਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਦਰਗਾਹ 'ਤੇ ਜਾਣਾ ਵੀ ਇੱਕ ਧਾਰਮਿਕ ਜਗ੍ਹਾ 'ਤੇ ਜਾਣਾ ਹੈ ਜੋ ਕਿ ਇੱਕ ਧਾਰਮਿਕ ਭਾਵਨਾ ਹੈ ਜੋ ਕਿ ਮੁਸਲਮਾਨ ਹੁੰਦੇ ਹਨ ਉਹਨਾਂ ਦੇ ਧਰਮ ਦੀ ਇੱਕ ਇਹ ਧਾਰਮਿਕ ਭਾਵਨਾ ਹੈ ਵਰਤ ਰੱਖਣਾ ਅਤੇ ਰੋਜ਼ੇ ਰੱਖਣਾ ਵੀ ਉਸ ਪਰਮਾਤਮਾ ਦੇ ਦਿੱਤੇ ਹੋਏ ਆਦੇਸ਼ 'ਤੇ ਚੱਲਣਾ ਹੈ ਕਿਉਂਕਿ ਬੀ ਵੱਖ ਵੱਖ ਧਰਮਾਂ ਦੇ ਵਿੱਚ ਇਸਦੀਆਂ ਵੱਖ ਵੱਖ ਮਹੱਤਤਾਵਾਂ ਹਨ ਜੋ ਕਿ ਦੁਰਕਾਰੀਆਂ ਨਹੀਂ ਜਾ ਸਕਦੀਆਂ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਧਾਰਮਿਕ ਰੀਤਾਂ ਹਨ ਜੋ ਕਿ ਬਹੁਤ ਹੀ ਮਹੱਤਵਪੂਰਨ ਹਨ ਜੋ ਕਿ ਸਾਨੂੰ ਸਾਡੇ ਧਰਮ ਦੇ ਨਾਲ ਜੋੜੀਆਂ ਜੋੜੀ ਰੱਖਦੀਆਂ ਹਨ ਅਤੇ ਸਾਡੇ ਸੱਭਿਆਚਾਰ ਦੇ ਵਿੱਚ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਅਤੇ ਅ ਅਸੀਂ ਪੰਜਾਬੀ ਹਾਂ ਸਾਡੇ ਧਰਮ ਦੇ ਵਿੱਚ ਸਿਰਫ ਇਹੀ ਮਹੱਤਤਾ ਹੈ ਕਿ ਸਭ ਦਾ ਭਲਾ ਮੰਗੋ ਸਰਬੱਤ ਦਾ ਭਲੇ ਵਿੱਚ ਹੀ ਆਪਣਾ ਭਲਾ ਹੈ ਅਤੇ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਵੀ ਪਰਮਾਤਮਾ ਨੂੰ ਯਾਦ ਕਰ ਸਕਦੇ ਹੋਂ ਜਿਸ ਨਾਲ ਤੁਹਾਡੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ ਇਸ ਲਈ ਕਿਸੇ ਦਰਗਾਹ ਜਾਂ ਮੰਦਰ ਵਿੱਚ ਜਾਣਾ ਜ਼ਰੂਰੀ ਨਹੀਂ ਹੈ ਸਾਡੇ ਧਰਮ ਦੇ ਹਿਸਾਬ ਦੇ ਅਤੇ ਸੱਭਿਆਚਾਰ ਦੇ ਹਿਸਾਬ ਦੇ ਨਾਲ ਬੰਦੇ ਦੇ ਮਨ ਨੂੰ ਸ਼ਾਂਤ ਕਰਨ ਦੇ ਲਈ ਉਸਦਾ ਮਨ ਸਾਫ ਹੋਣਾ ਜ਼ਰੂਰੀ ਹੈ ਉਸਦੇ ਲਈ ਬਾਹਰੀ ਦਿਖਾਵਾ ਕਰਨਾ ਜ਼ਰੂਰੀ ਨਹੀਂ ਹੈ ਮੇਰਾ ਵੀ ਆਪਣਾ ਇਹੀ ਮੰਨਣਾ ਹੈ ਕਿ ਹਰੇਕ ਧਰਮ ਦਾ ਇੱਕ ਹੀ ਉਦੇਸ਼ ਹੈ ਸਾਰੇ ਧਰਮ ਬਰਾਬਰ ਹਨ ਅਤੇ ਸਾਰੇ ਧਰਮਾਂ ਦੀਆਂ ਅਲੱਗ ਅਲੱਗ ਧਾਰਮਿਕ ਰੀਤਾਂ ਹਨ ਜੋ ਕਿ ਦੁਰਕਾਰੀਆਂ ਨਹੀਂ ਜਾ ਸਕਦੀਆਂ ਕਿਸੇ ਵੀ ਧਰਮ ਦੀ ਕੋਈ ਵੀ ਰੀਤ ਗਲਤ ਨਹੀਂ ਹੋ ਸਕਦੀ ਇਹ ਹਰ ਇੱਕ ਧਰਮ ਦੀ ਆਪਣੀ ਆਪਣੀ ਭਾਵਨਾ ਅਤੇ ਮਹੱਤਤਾ ਹੁੰਦੀ ਹੈ